ਅੱਜ ਦੇ ਸਮੇਂ ਵਿੱਚ ਬਾਲ ਮਜ਼ਦੂਰੀ ਜਿਹੜਾ ਹੈ ਇੱਕ ਬਹੁਤ ਹੀ ਵੱਡਾ ਜੁਰਮ ਹੈ ਸਾਡੇ ਸੰਵਿਧਾਨ ਦੇ ਵਿੱਚ ਵੀ ਜਿਹੜਾ ਇਹ ਚੀਜ਼ ਲਿਖੀ ਗਈ ਹੈ ਕਿ ਚੌਦਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਸੀਂ ਕਿਤੇ ਵੀ ਹੋਟਲਾਂ 'ਚ ਦੁਕਾਨਾਂ ਦੇ ਵਿੱਚ ਕੰਮ ਨਹੀਂ ਕਰਾ ਸਕਦੇ ਜੇ ਕੋਈ ਇਵੇਂ ਕਰਦਾ ਹੈ ਤਾਂ ਉਹਦੇ 'ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਪਰ ਅਸੀਂ ਕਈ ਜਗ੍ਹਾ 'ਤੇ ਦੇਖਦੇ ਹਾਂ ਕਿ ਜਿਹੜੀ ਬਾਲ ਮਜ਼ਦੂਰੀ ਹਜੇ ਵੀ ਹੋ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਹੈ ਹੋਟਲਾਂ 'ਤੇ ਰੱਖ ਕੇ ਦੁਕਾਨਾਂ 'ਤੇ ਜਿਹੜੀ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ ਕਿਤੇ ਬੱਚੇ ਭਾਂਡੇ ਧੋ ਰਹੇ ਹੁੰਦੇ ਹੈ ਕਿਤੇ ਸਾਫ਼ ਸਫ਼ਾਈ ਕਰ ਰਹੇ ਹੁੰਦੇ ਹੈ ਪਰ ਜੇ ਇਵੇਂ ਸਾਨੂੰ ਕਿਤੇ ਵੀ ਨਜ਼ਰ ਆਉਂਦਾ ਹੈ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਹੈ ਕੋਟ ਵਿੱਚ ਕੇਸ ਦਰਜ ਕਰ ਸਕਦੇ ਹਾਂ ਇਸ ਕਰਕੇ ਬਾਲ ਮਜ਼ਦੂਰੀ ਨੂੰ ਆਪਾਂ ਇਸ ਤਰੀਕੇ ਨਾਲ ਜਿਹੜਾ ਰੋਕ ਸਕਦੇ ਹਾਂ